ਹੈਲੋ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਜਗਦੀਸ਼ ਕੁਮਾਰੀ ਮੈਂ ਤੁਹਾਨੂੰ ਰਾਜ ਦੀਆਂ ਰਾਜ ਬਾਰੇ ਦੱਸਣਾ ਚਾਹੁੰਦੀ ਹਾਂ ਜੇਕਰ ਸਾਨੂੰ ਮੌਕਾ ਮਿਲੇ ਤਾਂ ਮੈਂ ਪੰਜਾਬ ਰਾਜ ਦਾ ਸੱਭਿਆਚਾਰ ਦਿਖਾਉਣਾ ਚਾਹਾਂਗੀ ਜਿਸ ਵਿੱਚ ਸਾਡੇ ਕੱਪੜੇ ਖਾਣ ਪੀਣ ਰਹਿਣ ਸਹਿਣ ਆਦਿ ਸ਼ਾਮਲ ਹੈ ਮੈਂ ਦਿਖਾਉਣਾ ਚਾਹਾਂਗੀ ਕਿ ਸਾਡਾ ਸੱਭਿਆਚਾਰਕ ਕਿੰਨਾ ਮਹਾਨ ਹੈ ਅਤੇ ਕਿੰਨੇ ਸ਼ਹੀਦ ਸ਼ਹੀਦ ਵੀ ਇੱਥੇ ਹੋਏ ਹਨ ਅਤੇ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ ਸਾਡੇ ਵਾਸਤੇ ਗੁਰੂਆਂ ਨੇ ਕੀ ਕੁਛ ਨਹੀਂ ਕੀਤਾ ਸਾਨੂੰ ਇਹ ਸਭ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਗੁਰੂਆਂ ਨੇ ਸਾਡੇ ਵਾਸਤੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਾਡੀਆਂ ਮਰਿਆਦਾ ਦੀ ਮਰਿਆਦਾ ਦੱਸਣਾ ਚਾਹਾਂਗੀ ਕਿ ਸਾਡੇ ਵਾਸਤੇ ਸਾਡੇ ਸਾਡੇ ਦੇਸ਼ ਸਾਡੇ ਦੇਸ਼ ਨੂੰ ਕੀ ਦਿਖਾਇਆ ਗਿਆ ਹੈ ਅਤੇ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕੀ ਕੀ ਕੀਤਾ ਹੈ ਕੀ ਕੀ ਕੁਰਬਾਨੀਆਂ ਦਿੱਤੀਆਂ ਹਨ ਅਤੇ ਸਾਨੂੰ ਇਹ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਸਾਨੂੰ ਸਭ ਕੁਛ ਸਮਝਣਾ ਚਾਹੀਦਾ ਹੈ ਅਤੇ ਸਾਰਾ ਕੁਛ ਵਧੀਆ ਕਰਨਾ ਚਾਹੀਦਾ ਹੈ